ਅੰਮ੍ਰਿਤਸਰ ਦੀ ਮਹੱਤਤਾ ਬਾਰੇ ਮੈਂ ਤੁਹਾਨੂੰ ਡਟੇਲ ਦੇ ਵਿੱਚ ਦੱਸ ਰਿਹਾ ਹੈ ਕਿ ਇਹ ਸਿੱਖਾਂ ਦਾ ਸਭ ਤੋਂ ਉੱਤਮ ਤਖ਼ਤ ਹੈ ਜਿਸਦੀ ਕੇ ਨੀਂਹ ਮੀਆਂ ਮੀਰ ਨੇ ਰੱਖੀ ਸੀ ਇਹ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ ਅਤੇ ਜੀ ਇੱਥੇ ਕੋਈ ਭੇਦ ਭਾਵ ਕਿਸੇ ਨਾਲ ਨਹੀਂ ਹੁੰਦਾ ਚਾਰ ਵਰਨਾਂ ਦਾ ਇਹ ਸਾਂਝਾ ਤਖ਼ਤ ਹੈ ਚਾਰ ਗੇਟ ਬਣੇ ਹੋਏ ਹਨ ਇੱਥੇ ਦੁੱਖ ਭੰਜਣੀ ਬੇਰੀ ਹੈ ਜਿਹੜੇ ਕਿ ਦੁੱਖਾਂ ਨੂੰ ਦੂਰ ਕੀਤਾ ਜਾਂਦਾ ਇੱਥੇ ਬਾਕੀ ਮੈਨੂੰ ਸਾਲ ਦੇ ਵਿੱਚ ਕਈ ਵਾਰ ਜਾਣ ਦਾ ਮੌਕਾ ਮਿਲਦਾ ਇੱਥੇ ਜਾ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਕਿਉਂਕਿ ਇੱਥੇ ਹਰ ਕਿਸਮ ਦੇ ਭੇਦ ਭਾਵ ਤੋਂ ਬਿਨਾਂ ਕੋਈ ਵੀ ਮਨੁੱਖ ਇੱਥੇ ਆ ਜਾ ਸਕਦਾ ਅਤੇ ਇੱਥੇ ਲੰਗਰ ਹਰ ਵੇਲੇ ਵਰਤਦਾ ਰਹਿੰਦਾ ਅਤੇ ਸਾਨੂੰ ਇੱਥੋਂ ਬਹੁਤ ਕੁਝ ਸਿੱਖਿਆ ਮਿਲਦੀ ਹੈ ਇਹ ਹਰ ਇੱਕ ਨੂੰ ਇੱਥੇ ਜਾਣਾ ਚਾਹੀਦਾ ਹੈ ਧੰਨਵਾਦ